ਮੇਰਾ ਇੱਕ ਯਾਰ ਦੋਸਤ ਹੈ ਸੰਦੀਪ ਸਿੰਘ ਉਹ ਕਿਸਾਨ ਮੋਰਚੇ 'ਚ ਗਿਆ ਸੀ ਅਤੇ ਉੱਥੇ ਜਦ ਮੋਰਚਾ ਲੱਗਿਆ ਹੋਇਆ ਸੀ ਅਤੇ ਕੁਛ ਕਿਸਾਨਾਂ ਨੂੰ ਉਨ੍ਹਾਂ ਨੇ ਚੱਕ ਕੇ ਜੇਲ੍ਹਾਂ 'ਚ ਵੀ ਪਾਇਆ ਅਤੇ ਸਾਡੇ ਯਾਰ ਦੋਸਤ ਸੰਦੀਪ ਸਿੰਘ ਦਾ ਵੀ ਨੰਬਰ ਲੱਗ ਗਿਆ ਅਤੇ ਉਹਨਾਂ ਨੂੰ ਬੱਸਾਂ 'ਚ ਭਰ ਕੇ ਲਖਨਊ ਦੇ ਕੋਲ ਕੋਈ ਜੇਲ੍ਹ ਹੈ ਉੱਥੇ ਲੈ ਗਏ ਸੀ ਅਤੇ ਉੱਥੇ ਚਲੋ ਧੱਕੇ ਧੁੱਕੇ ਖਾਂਦੇ ਕਿਸੇ ਤਰ੍ਹਾਂ ਉਹਨਾਂ ਨੇ ਮਤਲਬ ਕਿ ਟਾਇਮ ਪਾਰ ਕਰਿਆ ਆਪਣਾ ਪਰ ਜਦ ਉੱਥੇ ਦੀ ਗੱਲ ਦੱਸਦਾ ਸੀ ਖਾਣੇ ਬਾਰੇ ਬੜਾ ਅਤੇ ਉੱਥੇ ਖਾਣੇ ਦੇ ਵਿੱਚ ਉਨ੍ਹਾਂ ਨੂੰ ਦਾਲ ਕਹਿੰਦੇ ਹੁੰਦੇ ਸੀ ਕਹਿੰਦੇ ਦਾਲ ਹੈ ਕਹਿੰਦੇ ਦਾਲ ਤਾਂ ਸਾਨੂੰ ਮਿਲਦੀ ਨਹੀਂ ਸੀ ਪਾਣੀ ਓ ਹੀ ਹੁੰਦਾ ਸੀ ਅਤੇ ਜਦ ਉਹ ਸੁਣਾਉਂਦਾ ਨਾ ਕਹਿੰਦਾ ਨਾਲ ਦੇ ਬੈਠ ਕੇ ਕਹਿੰਦੇ ਹੁੰਦੇ ਸੀ ਬਈ ਕੱਪੜੇ ਕੱਢ ਲਉ ਹੁਣ ਦਾਲ ਆ ਗਈ ਵੀ ਦਾਲ ਲੱਭਣੀ ਹੈ ਅਤੇ ਉਸ ਟਾਇਮ ਮੈਨੂੰ ਬੜੀ ਹਾਸੀ ਆਉਣੀ ਅਤੇ ਉਹਦੇ ਵਿੱਚ ਉਹ ਦੱਸ ਰਿਹਾ ਸੀ ਕਿ ਸਾਡੀ ਇੱਕ ਵਾਰੀ ਘਰ ਗੱਲ ਹੋਈ ਅਤੇ ਫ਼ੋਨ 'ਤੇ ਉਹਨੂੰ ਟਿੱਚਰਾਂ ਕਰਨ ਵੀ ਕੜਾਹ ਖਾ ਰਹੇ ਹੈ ਕਿ ਕਯਾ ਖਾ ਰਹੇ ਹੈ ਪਰ ਉੱਥੇ ਸਾਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹ ਇੱਕ ਉਹਦੇ ਨਾਲ ਹੋਈ ਵੀ ਘਟਨਾ ਜੋ ਮੈਨੂੰ ਬੜੀ ਹਾਸੀ ਆਉਂਦੀ ਹੈ ਉਹਦੇ ਉੱਤੇ